ਮੈਂ ਫੋਟੋਗ੍ਰਾਫੀ ਨੂੰ ਇੱਕ ਪੇਸ਼ੇ ਵਜੋਂ ਲੈਣ ਬਾਰੇ ਇਸ ਲਈ ਸੋਚਿਆ ਸੀ ਕਿਉਂਕਿ ਇਸਦੇ ਨਾਲ ਅਸੀਂ ਆਪਣੇ ਜ਼ਿੰਦਗੀ ਦੇ ਮਹੱਤਵਪੂਰਨ ਪਲ ਫੋਟੋਆਂ ਦੇ ਵਿੱਚ ਕੈਦ ਕਰ ਸਕਦੇ ਹਾਂ ਅੱਜ ਕੱਲ੍ਹ ਵਿਆਹ ਦੀ ਫੋਟੋਗ੍ਰਾਫੀ ਬਾਰੇ ਮੈਂ ਇਸ ਤਰੀਕੇ ਨਾਲ ਸੋਚਦਾ ਹਾਂ ਕਿ ਵਿਆਹ ਵਿੱਚ ਨਵੇਂ ਵਿਆਹੇ ਜੋੜਿਆਂ ਅਤੇ ਉਨ੍ਹਾਂ ਸਾਰੇ ਲੋਕਾਂ ਲਈ ਕਾਫ਼ੀ ਤਣਾਅਪੂਰਨ ਹੋ ਸਕਦਾ ਹੈ ਜੋ ਸੰਗਠਨ ਦੀ ਗੱਲ ਕਰਦੇ ਹਨ ਇਹ ਦੇਖਦੇ ਹੋਏ ਕਿ ਵਿਆਹ ਦਾ ਦਿਨ ਲੋਕਾਂ ਦੇ ਜੀਵਨ ਵਿੱਚ ਸਭ ਤੋਂ ਵੱਧ ਖੂਬਸੂਰਤ ਦਿਨਾਂ ਵਿੱਚੋਂ ਇੱਕ ਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਸਭ ਤੋਂ ਛੋਟੀ ਤੋਂ ਛੋਟੀ ਚੀਜ਼ ਇੱਕ ਵੀਡੀਓ ਜਾਂ ਫੋਨ ਦੇ ਫੋਟੋ ਦੇ ਵਿੱਚ ਕੈਦ ਹੋਵੇ ਇਸ ਲਈ ਇਹ ਇੱਕ ਵਧੀਆ ਖਿੱਤਾ ਹੈ ਜਿਸਦੇ ਨਾਲ ਅਸੀਂ ਫੋਟੋਗ੍ਰਾਫੀ ਇੱਕ ਗੰਭੀਰ ਨੌਕਰੀ ਅਤੇ ਇੱਕ ਗੰਭੀਰ ਜ਼ਿੰਮੇਵਾਰੀ ਹੈ ਇਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਸਭ ਤੋਂ ਵਧੀਆ ਢੰਗ ਨਾਲ ਰਿਕਾਡਡ ਕਰਨਾ ਇਹ ਸਭ ਤੋਂ ਖੂਬਸੂਰਤ ਪਲ ਯਾਦਾਂ ਦੇ ਰੂਪ ਵਿੱਚ ਰਹਿਣਗੇ ਇਸ ਤੋਂ ਇਲਾਵਾ ਫੋਟੋਗ੍ਰਾਫੀ ਉਮੀਦਾਂ 'ਤੇ ਖਰਾ ਉਤਾਰਨ ਲਈ ਸੱਚਮੁੱਚ ਬਹੁਤ ਦਬਾਓ ਹੈ ਇਹ ਹੀ ਕਾਰਨ ਹੈ ਕਿ ਫੋਟੋਗ੍ਰਾਫੀ ਫੋਟੋਗ੍ਰਾਫਰਾਂ ਲਈ ਪ੍ਰਤੀਵਤਾ ਇਲਾਵਾ ਸੰਗਠਨ ਸਿਰਜਣਾਤਮਿਕਤਾ ਡਿਜਾਇਨ ਸਥਿਤੀ ਅਤੇ ਇਸ ਤਰ੍ਹਾਂ ਦੇ ਹੋਰ ਕਾਫ਼ੀ ਕਾਬਲਿਅਤਾਂ ਨੂੰ ਦਰਸਾਉਂਦੀ ਹੈ ਆਓ ਅਸੀਂ ਇਸਨੂੰ ਇਮਾਨਦਾਰ ਅਤੇ ਧੀਰਜ ਬਣਾਈਏ ਅੱਜ ਕੱਲ੍ਹ ਤੁਸੀਂ ਆਪਣੇ ਹੁਨਰ ਨੂੰ ਜਿੰਨਾ ਹੋ ਸਕੇ ਸਭ ਤੋਂ ਵਧੀਆ ਪ੍ਰਦਰਸ਼ਿਤ ਕਰਨ ਦੇ ਲਈ ਤੁਸੀਂ ਆਪਣੀ ਕਲਾ ਇੱਕ ਫੋਟੋ ਜਾਂ ਵੀਡੀਓ ਪੇਸ਼ ਕਰਕੇ ਸਾਬਿਤ ਕਰ ਸਕਦੇ ਹਾਂ ਉਹ ਸਾਵਦਿਕ ਤੌਰ 'ਤੇ ਤੁਹਾਡੇ ਕੰਮ ਦੀ ਪੇਸ਼ਕਾਰੀ ਹੋਵੇਗੀ ਇਸ ਗੱਲ ਦਾ ਸੂਚਕ ਹੋਵੇਗਾ ਕਿ ਤੁਸੀਂ ਉਸ ਦਿਨ ਨਵੇਂ ਵਿਆਹੇ ਜੋੜਿਆਂ ਲਈ ਹੋਰ ਸੁੰਦਰ ਬਣਾਉਣ ਲਈ ਕੀ ਕੀ ਕਰ ਸਕਦੇ ਹੋ ਸਾਵਧਾਨੀਆਂ ਨਾਲ ਯੋਜਨਾਵਾਂ ਦਾ ਪੈਕੇਜ ਅਤੇ ਆਕਰਸ਼ਿਤ ਲਿਖਤੀ ਪ੍ਰਸਾਰ ਤੁਹਾਡੇ ਹੋਰਾਂ ਗਾਹਕਾਂ ਨੂੰ ਬੰਦ ਨਹੀਂ ਕਰੇਗੀ ਪਰ ਜੇਕਰ ਤੁਹਾਡੀ ਸੇਵਾ ਵਧੀਆ ਹੈ ਤਾਂ ਬਹੁਤ ਸਾਰੇ ਨਵੇਂ ਰੈਫਲਰ ਬਾਰੇ ਸੁਚੇਤ ਹੋ ਸਕਦੇ ਹੋ ਧੰਨਵਾਦ